ਇੱਕ ਮਾਰਸ਼ਲ ਆਰਟ ਕਲਾਕਾਰ ਤੌਰ 'ਤੇ ਮੇਰੇ ਵਿੱਚ ਬਹੁਤ ਬਦਲਾਵ ਆਏ ਹਨ ਪਰ ਮੇਨ ਬਦਲਾਵ ਜਿਸ ਨੇ ਮੇਰੀ ਮਾਨਸਿਕਤਾ ਨੂੰ ਬਦਲਿਆ ਹੈ ਅਤੇ ਮੇਰੀ ਮਾਨਸਿਕਤਾ ਵਿੱਚ ਫਿਟ ਬੈਠਾ ਹੈ ਉਹ ਹੈਗਾ ਹੈ ਫੋਕਸ ਸਾਨੂੰ ਸਭ ਤੋਂ ਪਹਿਲਾਂ ਆਹੀ ਗੱਲ ਸਿਖਾਈ ਜਾਂਦੀ ਹੈ ਕਿ ਤੁਸੀਂ ਆਪਣੇ ਗੋਲ 'ਤੇ ਫੋਕਸ ਕਰੋ ਕਿ ਉਸਨੂੰ ਕਿਵੇਂ ਹਾਸਲ ਕਰਨਾ ਹੈ ਕਿਵੇਂ ਉਸਨੂੰ ਆਪਾਂ ਬੈਟਰ ਕਰ ਸਕੀਏ ਉਹ ਕਹਿੰਦੇ ਲੋਕ ਇੱਕੋ ਚੀ ਇਹ ਹ ਅਲੱਗ ਅਲੱਗ ਚੀਜ਼ਾਂ ਨੂੰ ਅਲੱਗ ਅਲੱਗ ਤਰੀਕੇ ਨਾਲ ਪ੍ਰੈਕਟਿਸ ਕਰਦੇ ਨੇ ਤੁਸੀਂ ਇੱਕੋ ਚੀਜ਼ ਨੂੰ ਅਲੱਗ ਅਲੱਗ ਤਰੀਕੇ ਨਾਲ ਪ੍ਰੈਕਟਿਸ ਕਰਕੇ ਦੇਖੋ ਫੇਰ ਦੇਖੋ ਤੁਹਾਡੇ ਕਿਵੇਂ ਤੁਸੀਂ ਇੱਕੋ ਚੀਜ਼ 'ਚ ਨਿੱਖਰ ਕੇ ਬਾਹਰ ਆਉਂਦੇ ਇਸਦੇ ਵਿੱਚ ਆਹ ਹੁੰਦਾ ਕਿ ਆਪਾਂ ਮਾਰਸ਼ਲ ਆਰਟ ਖੇਡ ਤਾਂ ਲੈਂਦੇ ਹਾਂ ਕਈ ਡਰ ਦੇ ਮਾਰੇ ਇਹਨੂੰ ਛੱਡ ਜਾਂਦੇ ਨੇ ਚਲੋ ਸੱਟਾਂ ਸਭ ਦੇ ਲੱਗਦੀਆਂ ਜੀ ਕਿਉਂਕਿ ਉਹ ਇਹ ਇਸ ਦੇ ਨਾਲ ਬੰਦਾ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਨਹੀਂ ਕਰਦਾ ਸਗੋਂ ਬਹਾਦਰ ਮਹਿਸੂਸ ਕਰਦਾ ਹੈ ਅਤੇ ਆਪਣੇ ਸਰੀਰ ਨੂੰ ਵੀ ਫਿਟ ਫਿਟ ਰੱਖਦਾ ਹੈ ਅਤੇ ਤਗੜਾ ਬਣਾਉਂਦਾ ਹੈ ਅਤੇ ਇਸ ਦੇ ਨਾਲ ਅਸੀਂ ਆਪਣਾ ਸੈਲਫ ਡਿਫੈਂਸ ਵੀ ਕਰ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਦਾ ਮਾਹੌਲ ਤਾਂ ਉਂਝ ਵੀ ਬਹੁਤ ਖਰਾਬ ਚੱਲ ਰਿਹਾ ਇਹ ਸਾਨੂੰ ਬਹੁਤ ਥਾਵਾਂ 'ਤੇ ਹੈਲਪ ਦਿੰਦਾ ਹੈ ਮੇਨਲੀ ਇਹ ਕਿਉਂਕਿ ਜ਼ਰੂਰੀ ਹੈ ਲੇਡੀਜ਼ ਵਾਸਤੇ ਸਾਨੂੰ ਇਸ ਪੜ੍ਹਾਇਆ ਜਾਂਦਾ ਹੈ ਉੱਥੇ ਇਹਦੀ ਰੋਲ ਬੁੱਕ ਵੀ ਤਿਆਰ ਕੀਤੀ ਗਈ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਿਸ ਦੇ ਵਿੱਚ ਇਸ ਦੇ ਚਾਰ ਸੌ ਰੂਲ ਲਿਖੇ ਗਏ ਹਨ ਵ ਅਵਤਾਰ ਸਿੰਘ ਜੀ ਵੱਲੋਂ ਅਤੇ ਇਸ ਦਾ ਇੰਨਾ ਕੁ ਮੈਂ ਅੱਜ ਤੁਹਾਨੂੰ ਫੀਡਬੈਕ ਦੇ ਰਿਹਾ ਧੰਨਵਾਦ ਜੀ